ਇੱਕ ਫੋਟੋ ਕਈ ਤਰ੍ਹਾਂ ਦੀਆਂ ਕਹਾਣੀਆਂ ਦੱਸ ਸਕਦੀ ਹੈ ਸਾਨੂੰ ਸੁਨੇਹੇ ਵੀ ਦੇ ਸਕਦੀ ਆ ਪੁਰਾਣੀਆਂ ਯਾਦਾਂ ਵੀ ਤਾਜ਼ਾ ਕਰਾ ਸਕਦੀ ਹੈ ਅਤੇ ਉਹ ਸਮਾਂ ਵੀ ਸਾਨੂੰ ਯਾਦ ਕਰਾ ਸਕਦੀ ਹੈ ਮੈਂ ਤੁਹਾਨੂੰ ਉਦਾਹਰਨ ਦੇ ਤੌਰ 'ਤੇ ਦੱਸਦਾ ਜਿੱਦਾਂ ਅਸੀਂ ਤਿੰਨ ਕੁ ਸਾਲ ਪਹਿਲਾਂ ਹਿਮਾਚਲ ਘੁੰਮਣ ਗਏ ਸੀਗੇ ਹਿਮਾਚਲ ਪ੍ਰਦੇਸ਼ ਅਤੇ ਉੱਥੇ ਇੱਕ ਕੋਕਸਰ ਸ਼ੈ ਸ਼ਹਿਰ ਸੀਗਾ ਉੱਥੇ ਬਰਫ ਦਾ ਪਹਾੜ ਸੀ ਪੂਰਾ ਅਤੇ ਉੱਥੇ ਅਸੀਂ ਦੋਸਤਾਂ ਨੇ ਫੋਟੋਆਂ ਖਿੱਚੀਆਂ ਹੋਈਆਂ ਸੀਗੀਆਂ ਉਦੋਂ ਫੋਟੋਆਂ ਖਿੱਚੀਆਂ ਉਹ ਉਦੋਂ ਦੀਆਂ ਹੁਣ ਫੋਨ 'ਚ ਮੇਰੇ ਸਾਹਮਣੇ ਆ ਗਈ ਤਿੰਨ ਸਾਲ ਬਾਅਦ ਅੱਜ ਜਦੋਂ ਮੈਂ ਫੋਟੋ ਦੇਖੀ ਤਾਂ ਐ ਜਿਵੇਂ ਤੁਸੀਂ ਕਹਿ ਲਓ ਉਵੇਂ ਹੀ ਪ੍ਰੋਪਰ ਚੰਗੀ ਤਰ੍ਹਾਂ ਉਹ ਸੀਨ ਮੇਰੀਆਂ ਅੱਖਾਂ ਅੱਗੇ ਆ ਗਏ ਉਹ ਬਰਫ 'ਤੇ ਅਸੀਂ ਸਕੇਟਿੰਗ ਕੀਤੀ ਅਸੀਂ ਬਰਫ ਦੇ ਗੋਲੇ ਬਣਾ ਕੇ ਖੇਡੇ ਇੱਕ ਦੂਜੇ ਨਾਲ ਸਾ ਸਾਡੇ ਉਹ ਸੂਟ ਜਿਹੇ ਵੀ ਪਾਏ ਹੋਏ ਸੀ ਉਦੋਂ ਉੱਥੇ ਬਰਫ ਦੇ ਉੱਤੇ ਖੇਡਣ ਲਈ ਅਸੀਂ ਪੂਰਾ ਉਦੋਂ ਕਹਿ ਸਕਦੇ ਹੋ ਵੀ ਇੰਜੋਏ ਕੀਤਾ ਆਨੰਦ ਲਿਆ ਅਤੇ ਹੁਣ ਅੱਜ ਫੋਟੋ ਦੇਖੀ ਅਤੇ ਉਹ ਕਹਾਣੀ ਹੈ ਉਵੇਂ ਹੀ ਅੱਖਾਂ ਅੱਗੇ ਯਾਦ ਆ ਗਈ ਧੰਨਵਾਦ ਜੀ